ਪੰਦਰ੍ਹਾਂ ਜਨਵਰੀ ਉੱਨੀ ਸੌ ਇਕਹੱਤਰ ਦਸ ਅਪ੍ਰੈਲ ਦੋ ਹਜ਼ਾਰ ਪੰਜ ਸੱਤ ਦਸੰਬਰ ਉੱਨੀ ਸੌ ਸਤਾਨਵੇਂ ਵੀਹ ਦਸੰਬਰ ਦੋ ਹਜ਼ਾਰ ਤੇਰ੍ਹਾਂ ਛੱਬੀ ਨਵੰਬਰ ਦੋ ਹਜ਼ਾਰ ਚੌਦ੍ਹਾਂ